ਸਤਿ ਸ਼੍ਰੀ ਅਕਾਲ ਸਰ ਮੁਰਗੀਆਂ ਨੂੰ ਮੁਰਗੇ ਖਾਨੇ ਵਿੱਚ ਰੱਖਣ ਨਾਲ ਸਾਨੂੰ ਉਹਨਾਂ ਦੀ ਬਹੁਤ ਹੀ ਦੇਖ ਰੇਖ ਕਰਨੀ ਪੈਂਦੀ ਹੈ ਇਸ ਕਰਕੇ ਮੁਰਗੀਆਂ ਨੂੰ ਉਹਨਾਂ ਨੂੰ ਫੀਡ ਦਾਣਾ ਚੰਗੀ ਤਰ੍ਹਾਂ ਦੇਖ ਰੇਖ ਕਰਕੇ ਟਾਈਮ ਸਿਰ ਦਿੱਤਾ ਜਾਂਦਾ ਹੈ ਇਸ ਕਰਕੇ ਉਹਨੂੰ ਮੁਰਗਿਆਂ ਨੂੰ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਮੁਰਗੀਆਂ ਨੂੰ ਮੁਰਗੀਆਂ ਨੂੰ ਥੋੜ੍ਹੀ ਜਿੰਨੀ ਖੁੱਲੇ ਵਾਤਾਵਰਨ ਵਿੱਚ ਵੀ ਛੱਡਣਾ ਚਾਹੀਦਾ ਹੈ ਜ਼ਿਆਦੀ ਉਹਨਾਂ ਨੂੰ ਗਰਮਾਇਸ਼ ਚਾਰ ਚੁਫੇਰੋ ਦਿੱਤੀ ਜਾਵੇ ਮੁਰਗਿਆਂ ਨੂੰ ਮੁਰਗਿਆਂ ਨੂੰ ਮਰਨ ਦਾ ਡਰ ਹੋ ਜਾਂਦਾ ਹੈ ਇਸ ਕਰਕੇ ਉਹਨਾਂ ਨੂੰ ਥੋੜ੍ਹੇ ਖੁੱਲ੍ਹੇ ਵਾਤਾਵਰਨ ਵਿੱਚ ਰੱਖਣਾ ਚਾਹੀਦਾ ਹੈ ਮੁਰਗਿਆਂ ਤੋਂ ਸਾਨੂੰ ਬਹੁਤ ਹੀ ਰੁਜ਼ਗਾਰ ਮਿਲਦਾ ਹੈ ਇਸ ਕਰਕੇ ਮੁਰਗੇ ਮੁਰਗੀਆਂ ਮੁਰਗੀਆਂ ਸਾਨੂੰ ਅੰਡੇ ਵੀ ਪ੍ਰਾਪਤ ਕਰਦੀਆਂ ਨੇ ਉਹਨਾਂ ਨੂੰ ਟਾਈਮ ਦੀ ਖੁਰਾਕ ਦਿੱਤੀ ਜਾਵੇ ਅਤੇ ਮੁਰਗੀਆਂ ਸਾਨੂੰ ਆਂਡੇ ਵੀ ਪ੍ਰਾਪਤ ਕਰਦੀਆਂ ਹਨ ਇਸ ਕਰਕੇ ਮੁਰਗੀਆਂ ਅਤੇ ਮੁਰਗਿਆਂ ਦਾ ਮੀਟ ਵੀ ਤਿਆਰ ਕੀਤਾ ਜਾਂਦਾ ਹੈ